ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੀ ਹੁਣ ਬੋਲੀਵੁੱਡ ਦੇ ਵਿੱਚ ਕਿੱਦਾਂ ਦੇ ਕੱਪੜੇ ਪਾਏ ਜਾਂਦੇ ਕਿੱਦਾਂ ਦੇ ਪਹਿਰਾਵੇ ਪਾਏ ਜਾਂਦੇ ਹਨ ਕੋਈ ਵਧੀਆ ਵੀ ਹੁੰਦੇ ਸੱਭਿਆਚਾਰਕ ਵੀ ਹੁੰਦੇ ਹੈਗੇ ਕੋਈ ਸੱਭਿਆਚਾਰਕ ਵੀ ਹੁੰਦੇ ਹੈਗੇ ਜਿਹਨਾਂ ਨੂੰ ਲੋਕ ਪਸੰਦ ਕਰਦੇ ਆ ਵੀ ਜਿਹੜੇ ਜ਼ਿਆਦਾ ਪਸੰਦ ਕਰਦੇ ਆ ਜਿਵੇਂ ਕਿ ਸੱਭਿਆਚਾਰਕ ਜਿਹੜੇ ਪੰਜਾਬੀ ਸਿੰਗਰ ਆ ਜ਼ਿਆਦਾਤਰ ਸੱਭਿਆਚਾਰਕ ਕੱਪੜੇ ਪਾਉਂਦੇ ਹੈਗੇ ਵੀ ਸਲਵਾਰ ਸੂਟ ਜਾਂ ਫਿਰ ਕੋਈ ਫਰਾਕ ਵਗੈਰਾ ਗਾਊਨ ਐਵੇਂ ਦੀ ਡਰੈਸਾਂ ਤਿਆਰ ਹੋ ਵੀ ਪਾਉਂਦੇ ਗੇ ਤਾਂ ਫਿਰ ਵੀ ਇਹ ਜਿਹੀਆਂ ਡਰੈਸਾਂ ਫਿਰ ਮੇਰਾ ਮਨ ਵੀ ਕੀਤਾ ਹੈ ਜਿਵੇਂ ਕਿ ਨਿਮਰਤ ਖੈਰਾ ਦੇ ਨਿਮਰਤ ਖੈਰਾ ਨੀਰੂ ਬਾਜਵਾ ਇਹਨਾਂ ਸਾਰੀਆਂ ਦੇ ਕਿੰਨੇ ਵਧੀਆ ਵਧੀਆ ਕੱਪੜੇ ਪਾਏ ਹੁੰਦੇ ਹਨ ਤਾਂ ਫਿਰ ਉਸਨੂੰ ਉਸ ਤਰੀਕੇ ਨਾਲ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਇਸ ਤਰ੍ਹਾਂ ਦੇ ਕੱਪੜੇ ਬਣਾ ਕੇ ਪਾਵਾਂ ਤਾਂ ਫਿਰ ਜਿਵੇਂ ਦੇ ਉਹਨਾਂ ਦੇ ਗਾਊਨ ਪਾਏ ਸੀਗੇ ਉਸ ਤਰ੍ਹਾਂ ਦੇ ਮੈਂ ਵੀ ਗਾਊਨ ਦੀ ਕਟਿੰਗ ਕਰਕੇ ਕੱਪੜਾ ਮੰਗਾ ਕੇ ਅਤੇ ਗਾਊਨ ਤਿਆਰ ਕੀਤਾ ਸੀਗਾ ਆਪਦੇ ਵਾਸਤੇ ਅਤੇ ਮੈਂ ਦੂਜੇ ਰਿਸ਼ਤੇਦਾਰਾਂ ਨੂੰ ਵੀ ਇਹ ਚੀਜ਼ਾਂ ਤਿਆਰ ਕਰਕੇ ਦਿੱਤੀਆਂ ਜਿਵੇਂ ਦੇ ਉਹਨਾਂ ਨੂੰ ਪਸੰਦ ਸੀਗੇ ਜਿਹੜੇ ਵੀ ਐਕਟਰਸ ਦੇ ਕੱਪੜੇ ਉਹਨਾਂ ਨੂੰ ਪਸੰਦ ਸੀਗੇ ਉਹਦੇ ਨਾਲ ਦੇ ਹੀ ਮੈਂ ਬਣਾ ਕੇ ਦਿੱਤੇ ਹੈਗੇ ਮੈਨੂੰ ਸਟੀਚਿੰਗ ਦਾ ਕੰਮ ਵੀ ਬਹੁਤ ਵਧੀਆ ਆਉਂਦਾ ਗਾ ਜਿਸ ਕਰਕੇ ਵੀ ਜਿਹੜੇ ਰਿਸ਼ਤੇਦਾਰ ਹੈਗੇ ਸਾਡੇ ਵੀ ਮੇਤੋਂ ਹੀ ਬਣਵਾ ਲੈਂਦੇ ਹੈਗੇ ਜਿਹਨਾਂ ਦਾ ਵੀ ਪਹਿਰਾਵਾ ਜਿਹੜੇ ਵੀ ਐਕਟਰ ਦਾ ਪਹਿਰਾਵਾ ਉਹਨਾਂ ਨੂੰ ਵਧੀਆ ਲੱਗਦਾ ਗਾ ਜਿਵੇਂ ਕਿ ਮੈਂ ਨੀਰੂ ਬਾਜਵਾ ਦਾ ਵਧੀਆ ਲੱਗਦਾ ਗਾ ਅਤੇ ਨਿਮਰਤ ਖੈਰਾ ਦੇ ਵੀ ਸ਼ਰਾਰਾ ਸੂਟ ਜਾਂ ਪਾਲਾਜੋ ਸੂਟ ਸਲਵਾਰ ਸੂਟ ਗਾਊਨ ਵਗੈਰਾ ਫਰਾਕ ਇਸ ਤਰ੍ਹਾਂ ਦੇ ਕੱਪੜੇ ਵੀ ਉਹਨਾਂ ਦੇ ਵਧੀਆ ਲੱਗਦੇ ਹੈਗੇ ਉਸ ਤਰ੍ਹਾਂ ਵੀ ਮੈਂ ਆਪਦੇ ਵੀ ਜਿਵੇਂ ਮੇਰੀ ਰੀਝ ਹੈਗੀ ਜਿਵੇਂ ਮੈਨੂੰ ਪਸੰਦ ਹੈਗੇ ਮੈਂ ਉਸ ਟਾਈਪ ਦੇ ਵੀ ਆਪਦੇ ਕੱਪੜੇ ਬਣਾ ਕੇ ਆਪਦੇ ਪਾ ਸਕਦੀ ਹੈਗੀ ਮੈਨੂੰ ਉਸ ਤੋਂ ਬਸ ਜਿਵੇਂ ਕਿ ਹੁਣ ਆਪਣੇ ਸਟੀਚਿਗ ਆਉਂਦੀ ਹੈਗੀ ਉਹਦੇ ਰਿਗਾਰਡਿੰਗ ਫਿਰ ਆਪਾਂ ਇਹ ਚੀਜ਼ ਪਤਾ ਲੱਗ ਜਾਂਦੀ ਹੈਗੀ ਕਿ ਕਿਵੇਂ ਦੀ ਕਟਿੰਗ ਕੀਤੀ ਹੈ ਕਿਵੇਂ ਦੀ ਹੈਗੀ ਸਾਰੇ ਕੱਪੜੇ ਬਸ ਉਸ ਤਰੀਕੇ ਦੇ ਨਾਲ ਵੀ ਇਹ ਕੱਪੜੇ ਜਿਹੜੇ ਹੈਗੇ ਵੀ ਤਿਆਰ ਕਰ ਲੈਂਦੀ ਹਾਂ ਇੱਕ ਵਾਰੀ ਦੇਖ ਕੇ ਵੀ ਉਹ ਡਿਜ਼ਾਇਨ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਐਵੇਂ ਦਾ ਐਵੇਂ ਦਾ ਤਾਂ ਮੈਂ ਆਪਦੇ ਬਣਾਏ ਹੈਗੇ ਅਤੇ ਆਪਦੇ ਰਿਸ਼ਤੇਦਾਰਾਂ ਨੂੰ ਬਣਾ ਕੇ ਦਿਤੇ ਹੈਗੇ ਰਿਸ਼ਤੇਦਾਰਾਂ ਨੂੰ ਵੀ ਮੇਰੇ ਜਿਹੜੇ ਕੱਪੜੇ ਬਣਾਏ ਹੋਏ ਬਹੁਤ ਪਸੰਦ ਆਏ ਉਹਨਾਂ ਨੇ ਬਹੁਤ ਜ਼ਿਆਦਾ ਲਾਇਕ ਕੀਤੇ ਹੈਗੇ ਕੱਪੜਿਆਂ ਨੂੰ ਤਾਂ ਫਿਰ ਉਹ ਮੇਰੇ ਕੋਲ ਵਾਰੀ ਵਾਰੀ ਭੇਜ ਦਿੰਦੇ ਹੈਗੇ ਬਾਕੀ ਉਹਨਾਂ ਦੇ ਗਾਂਹ ਹੋਰ ਹੋਰ ਦੱਸ ਕੇ ਗਾਂਹ ਦੀ ਗਾਂਹ ਵੀ ਕਿਸੇ ਨੂੰ ਦੱਸ ਕੇ ਉਹਨਾਂ ਨੂੰ ਵੀ ਕਹਿ ਕੇ ਤਾਂ ਫਿਰ ਵੀ ਮੈਥੋਂ ਬਣਾ ਲੈਂਦੇ ਹੈਗੇ ਤਾਂ ਜਿਵੇਂ ਦੀ ਉਹ ਡਰੈਸ ਕਹਿੰਦੇ ਜਿਵੇਂ ਕਿ ਸੱਭਿਆਚਾਰਕ ਚੱਲਦਾ ਗਾ ਜਿਵੇਂ ਕਿ ਹੁਣ ਕਈ ਨਾ ਛੋਟੇ ਛੋਟੇ ਕੱਪੜੇ ਦੂਜੀ ਬਾਲੀਵੁੱਡ ਵਾਲੇ ਜਿਹੜੇ ਹੈਗੇ ਪਾਉਂਦੇ ਹੈਗੇ ਉਹ ਕਈਆਂ ਨੂੰ ਨਹੀਂ ਪਸੰਦ ਆਉਂਦੇ ਜਾਂ ਫਿਰ ਕਈਆਂ ਨੂੰ ਪਸੰਦ ਹੈਗੇ ਤਾਂ ਫਿਰ ਉਹ ਐਵੇਂ ਦੀ ਡਰੈਸਾਂ ਲੈਣ ਆਉਂਦੇ ਹੈਗੇ ਐਵੇਂ ਦੀਆਂ ਵੀ ਤਿਆਰ ਕਰ ਦਿੰਦੇ ਹੈਗੇ ਜਿਵੇਂ ਦੀਆਂ ਉਹ ਕਹਿੰਦੇ ਹੈਗੇ ਉਵੇਂ ਦੀਆਂ ਤਿਆਰ ਕਰਕੇ ਭੇਜ ਦਿੰਦੇ ਉਹਨਾਂ ਨੂੰ ਜਿਵੇਂ ਉਹਨਾਂ ਨੂੰ ਮਰਜ਼ੀ ਹੈਗੀ ਜੇ ਮੇਰੀ ਪਸੰਦ ਹੈਗੀ ਜਿਵੇਂ ਦੇ ਪਾਉਂਦੇ ਕੱਪੜੇ ਉਹ ਤਾਂ ਫਿਰ ਮੈਂ ਵੀ ਆਪਦੇ ਉਸ ਤਰ੍ਹਾਂ ਤਿਆਰ ਕਰਕੇ ਉਹ ਕਰ ਦਿੰਦੀ ਹੈਗੀ ਪਾ ਲੈਂਦੀ ਹਾਂ ਕੋਈ ਫੰਕਸ਼ਨ ਵਗੈਰਾ 'ਤੇ ਜਾਣਾ ਹੋਵੇ ਕਿਸੇ 'ਚ ਜਾਣਾ ਹੋਵੇ ਗਾਊਨ ਵਗੈਰਾ ਤਿਆਰ ਕਰਕੇ ਵਧੀਆ ਆਪਦਾ ਆਪਦੀ ਮਰਜ਼ੀ ਨਾਲ ਪਾ ਸਕਦੇ ਹੈਗੇ ਉਵੇਂ ਘੱਟ ਪੈਸਿਆਂ ਦੇ ਵਿੱਚ ਜਿਹੜਾ ਬਸ ਕੱਪੜਾ ਲਿਆ ਕੇ ਆਪਦੇ ਹੱਥ ਦੀ ਮਿਹਨਤ ਕਰਕੇ ਆਪਦਾ ਵੀ ਹੱਥ ਵੀ ਵਧੀਆ ਹੱਥੀਂ ਸਾਰਾ ਤਿਆਰ ਕਰਕੇ ਸੂਟ ਅਤੇ ਵਧੀਆ ਉਹਦੇ ਵਿੱਚ ਜਾ ਕੇ ਵਿਆਹ ਸ਼ਾਦੀ 'ਚ ਜਾ ਕੇ ਜਿੱਥੇ ਮਰਜ਼ੀ ਜਾ ਕੇ ਆਪਦਾ ਵਧੀਆ ਵੀ ਫੈਸ਼ਨ ਕਰ ਸਕਦੇ ਹੈਗੇ ਵੀ ਉੱਥੇ ਉਹ ਚੀਜ਼ ਦੇਖਣ ਨੂੰ ਵੀ ਇਹ ਚੀਜ਼ ਲੱਗਦੀ ਨਾ ਵੀ ਕਿੰਨੀ ਜ਼ਿਆਦਾ ਵੀ ਜਿਹੜੀ ਚੀਜ਼ ਜਚੇ ਪਾਏ ਵੀ ਉਹ ਚੀਜ਼ ਵੀ ਸਾਰਿਆਂ ਨਾਲੋਂ ਜ਼ਿਆਦਾ ਪਸੰਦ ਆਉਂਦੀ ਹੈ ਵੀ ਜਿਹੜੀ ਜਚੇ ਚੀਜ਼ ਪਾਈ ਉਹੀ ਚੀਜ਼ ਵੀ ਦੇਖਣ ਵਾਲੇ ਨੂੰ ਵੀ ਸੋਹਣੀ ਲੱਗੇ ਵੀ ਹਾਂ ਇਹ ਚੀਜ਼ ਕਿੰਨੀ ਸੋਹਣੀ ਆ ਤਾਂ ਉਸ ਟਾਈਪ ਦੇ ਵੀ ਆਪਦੇ ਕੱਪੜੇ ਬਣਾਓ ਵੀ ਜਿਹੜੇ ਹਿਸਾਬ ਨਾਲ ਵੀ ਅਗਲੇ ਨੂੰ ਪਸੰਦ ਆਉਣ ਵੀ ਤਾਂ ਕਰਕੇ ਜਿਵੇਂ ਦੇ ਬੋਲੀਵੁੱਡ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਪਿਆ ਗਾ ਜਿਵੇਂ ਜੇ ਉਹ ਚੱਲੀ ਜਾਂਦੇ ਬੋਲੀਵੁੱਡ ਵਾਲੇ ਅਤੇ ਉਵੇਂ ਦੀ ਵੀ ਸਾਰੇ ਕੱਪੜੇ ਅੱਜ ਕੱਲ੍ਹ ਪਾਉਂਦੇ ਜਿਵੇਂ ਦੇ ਫੈਸ਼ਨ ਨੂੰ ਚਲਾ ਦਿੰਦੇ ਉਵੇਂ ਦੇ ਹੀ ਫੈਸ਼ਨ ਵਾਲੇ ਕੱਪੜੇ ਪਾਉਂਦੇ ਹੈਗੇ ਜਿਸ ਟਾਈਮ ਵੀ ਉਹ ਪਾਉਂਦੇ ਕੱਪੜੇ ਹੋਣਗੇ ਪਸੰਦ ਕਰਦੇ ਆਗੇ ਅਤੇ ਜਿਵੇਂ ਦੇ ਬਸ